ਘਰ ਦੀ ਬਗੀਚੀ ਬਾਰੇ ਜਦੋਂ ਅਸੀਂ ਕਿਸੇ ਦੂਜੇ ਨੂੰ ਨੋਲੇਜ ਦਿੰਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਪਲਾਂਟ ਬਾਰੇ ਦੱਸਦੇ ਹਾਂ ਪਲਾਂਟ ਦੇ ਵਿੱਚ ਕਿਸ ਦੇ ਵਿੱਚ ਜ਼ਿਆਦਾ ਆਕਸੀਜਨ ਹੁੰਦੀ ਆ ਕਿਵੇਂ ਸਾਨੂੰ ਪਲਾਂਟ ਦੀ ਕੇਅਰ ਕਰਨੀ ਚਾਹੀਦੀ ਹੈ ਉਹ ਚੀਜ਼ਾਂ ਅਸੀਂ ਦੱਸਦੇ ਹੁੰਦੇ ਹਾਂ ਅਤੇ ਪਲਾਂਟ ਨੂੰ ਵਧੀਆ ਤਰੀਕੇ ਨਾਲ਼ ਜਿਵੇਂ ਖੁਦਾਈ ਕਰਨੀ ਆ ਹਫ਼ਤੇ ਬਾਅਦ ਅਸੀਂ ਖੁਦਾਈ ਕਰ ਸਕਦੇ ਹਾਂ ਪਾਣੀ ਪਾ ਸਕਦੇ ਹਾਂ ਕਿੰਨਾ ਕੁ ਪਾਣੀ ਪਾਉਣਾ ਉਸ ਚੀਜ਼ ਬਾਰੇ ਦੱਸਦੇ ਹਾਂ ਕਿਸੇ ਪਲਾਂਟ 'ਚ ਵੱਧ ਪੈਂਦਾ ਅਤੇ ਕਿਸੇ ਪਲਾਂਟ ਦੇ ਵਿੱਚ ਘੱਟ ਪਾਣੀ ਪੈਂਦਾ